ਮੇਰਾ ਨਾਮ ਭੀਮ ਸੈਨ ਹੈ ਮੈਂ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਗੱਲ ਕਰ ਰਿਹਾ ਅਸੀਂ ਮੈਂ ਖੇਤੀਬਾੜੀ ਕਰਦਾ ਹਾਂ ਜਿਸ ਵਿੱਚ ਲੱਖਾਂ ਦੀ ਆਮਦਨ ਹੁੰਦੀ ਹੈ ਬਹੁਤ ਸਾਰੇ ਕੰਮ ਕਰਦੇ ਹਨ ਖੁੱਲ੍ਹੀਆਂ ਜ਼ਮੀਨਾਂ ਹਨ ਉਰੇ ਅਤੇ ਸਾਡੇ ਪਿੰਡ ਦੇ ਮੁੰਡੇ ਇੰਟਰਨੈਸ਼ਨਲ ਖੇਡ ਕੇ ਆਏ ਹਨ ਕਬੱਡੀ ਜਿਸ ਕਰਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਦੇ ਹਨ ਅਤੇ ਬਹੁਤ ਸਾਡੇ ਉਰੇ ਬਹੁਤ ਸਾਰੀਆਂ ਫੈਕਟਰੀ ਹਨ ਜ਼ਿਲ੍ਹਾ ਨਵਾਂਸ਼ਹਿਰ ਦੇ ਵਿੱਚ ਜਿਸ ਕੰਗ ਗਰੀਬ ਪਰਿਵਾਰ ਨੂੰ ਵੀ ਕੰਮ ਮਿਲਦਾ ਹੈ ਆਪਣਾ ਰੋਟੀ ਅਰਾਮ ਚੱਲਦਾ ਹੈ ਅਤੇ ਬਹੁਤ ਸਾਰੇ ਸ ਸਹੂਲਤਾਂ ਹਨ ਗਰਾਊਂਡ ਖੇਡਣ ਨੂੰ ਸਾਰਾ ਕੁਛ ਮਿਲਦਾ ਹਨ ਉਰੇ ਸਹੂਲਤਾਂ ਬਹੁਤ ਹਨ ਅਤੇ ਰੋਡ ਵੀ ਇੱਕ ਦਮ ਨਵੇਂ ਹਨ ਉਰੇ ਕੋਈ ਉਹ ਨਹੀਂ ਹੈਗਾ